ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਿੰਘ ਫਰਨੀਚਰ ਤੋਂ ਬੋਲ ਰਹੇ ਅੱਛਾ ਜੀ ਆਪਣੇ ਕੋਲ ਨਵਾਂ ਫਰਨੀਚਰ ਹੁੰਦਾ ਜੀ ਅੱਛਾ ਜੀ ਉਹ ਜਾਣਕਾਰੀ ਲੈਣੀ ਸੀ ਥੋੜ੍ਹੀ ਉਹਦੇ ਬਾਰੇ ਅਸੀਂ ਜਾਣਕਾਰੀ ਲੈਣੀ ਸੀ ਆਪਣੇ ਜਿਵੇਂ ਬੈਡ ਵਗੈਰਾ ਬਾਰੇ ਅੱਛਾ ਜੀ ਠੀਕ ਆ ਜੀ ਆਪਾਂ ਵੱਲੋਂ ਨਵੀਂ ਕੋਠੀ ਤਿਆਰ ਕੀਤੀ ਆਪਾਂ ਜੀ ਹਾਂਜੀ ਜਿਵੇਂ ਆਪਾਂ ਨੂੰ ਬੈਡ ਚਾਹੀਦਾ ਉਹਦੇ 'ਚ ਅੱਠ ਬਾਏ ਅੱਠ ਫੁੱਟ ਦਾ ਜੀ ਐਲ ਈ ਡੀ ਲਈ ਆਪਣੀ ਚਾਹੀਦੇ ਜੀ ਅਤੇ ਹੋਰ ਆਪਣੇ ਜਿਹੜਾ ਗੇਟ ਵਗੈਰਾ ਹੋਵੇ ਜੀ ਹਾਂਜੀ ਕਿਹੜੀ ਕਿਹੜੀ ਲੱਕੜ ਆਪਣੇ ਕੋਲ ਜੀ ਅੱਛਾ ਸਾਗਵਾਨ ਠੀਕ ਹੈ ਜੀ ਟਾਹਲੀ ਦਾ ਕੀ ਰੇਟ ਆ ਜੀ ਟਾਹਲੀ ਦਾ ਕੀ ਰੇਟ ਆ ਜੀ

ਤੀਹ ਤੀਹ ਹਜ਼ਾਰ ਰੁਪਈਆ ਅੱਛਾ ਨਹੀਂ ਘੱਟ ਕਰ ਲਓ ਜਾਇਜ ਜਾਇਜ ਲਾ ਲਓ ਜੀ ਜਾਇਜ ਜਾਇਜ ਲਾ ਲਓ ਜੀ ਘੱਟ ਕਰ ਲਓ ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਹੋਰ ਆਪਾਂ ਨੂੰ ਦੱਸ ਕੁ ਦਿਨਾਂ 'ਚ ਚਾਹੀਦਾ ਜੀ ਹਾਂਜੀ ਹੋ ਜਾਵੇਗਾ ਜੀ ਚਲੋ ਤੁਸੀਂ ਜਿੰਨਾ ਜਲਦੀ ਹੋ ਸਕਿਆ ਤੇ ਮੰਨ ਲਓ ਕਰ ਦਿਓ ਜੀ ਹਾਂ ਠੀਕ ਹੈ ਨਹੀਂ ਗਰੰਟੀ ਵੀ ਹੋਊਗੀ ਨਾ ਲੱਕੜ ਦੀ ਅੱਛਾ ਜੀ ਅਤੇ ਮੰਨ ਲਓ ਆਪਣੇ ਜਿਵੇਂ ਬਾਥਰੂਮ ਵਗੈਰਾ ਦੇ ਗੇਟ ਵੀ ਚਾਹੀਦੇ ਆਪਾਂ ਨੂੰ ਜੀ ਲੱਕੜ ਵਾਲੇ ਬਣੇ ਬਣਵਾ ਦੋਂਗੇ ਜੀ ਠੀਕ ਆ ਜੀ ਅਤੇ ਆਪਣੀ ਕਿਚਨ 'ਚ ਵੀ ਆਪਾਂ ਤਿਆਰ ਕਰਨਾ ਸਾਰਾ ਕਿਚਨ ਜੀ ਰਸੋਈ ਜੀ ਹੋ ਜਾਵੇਗਾ ਜੀ ਅੱਛਾ ਕਿਚਨ ਦੇ ਕਿੰਨੇ ਪੈਸੇ ਲੱਗ ਜਾਣਗੇ ਸਾਰੇ ਜੀ ਨਹੀਂ ਆਪਾਂ ਵਧੀਆ ਮਟੀਰੀਅਲ ਲਗਾਉਣਾ ਪੂਰਾ ਲੱਕੜ ਦਾ ਵਧੀਆ ਜੀ ਅੱਛ ਅੱਛਾ ਜੀ ਠੀਕ ਆ ਜੀ ਠੀਕ ਆ ਠੀਕ ਆ ਜੀ ਮੈਨੂੰ ਨੰਬਰ ਦਿੱਤਾ ਸੀ ਅਤੇ ਅਗਾਂਹ ਜਾਣ ਪਛਾਣ ਵਾਲੇ ਕਿਸੇ ਨੇ ਜੀ ਮੈਂ ਸਿੰਘ ਫਰਨੀਚਰ ਵਾਲੇ ਕਹਿੰਦੇ ਵਧੀਆ ਕੰਮ ਕਰਦੇ ਠੀਕ ਹੈ ਠੀਕ ਹੈ ਜੀ ਚਲੋ ਤਾਂ ਫਿਰ ਕੋਈ ਗੱਲ ਨਹੀਂ ਫਿਰ ਕਿਸੇ ਦਿਨ ਆਉਂਦੇ ਅਸੀਂ ਤੁਹਾਡੀ ਸ਼ਾਪ 'ਤੇ ਠੀਕ ਹੈ ਜੀ ਫਿਰ ਮਿਲ ਕੇ ਕਰਦੇ ਗੱਲ ਜੀ